ਭੰਗੜਾ ਪੰਜਾਬ ਵਿੱਚ ਲੋਕ ਡਾਂਸ ਹੈ ਲੋਕ ਨਾਚ ਹੈ ਇਹ ਖੁਸ਼ੀ ਦੇ ਮੌਕੇ 'ਤੇ ਪਾਇਆ ਜਾਂਦਾ ਹੈ ਵਿਆਹ ਸ਼ਾਦੀ ਦੇ ਵਿੱਚ ਭੰਗੜਾ ਬੱਚੇ ਬੜੀ ਖੁਸ਼ੀ ਨਾਲ ਵੱਡੇ ਬੁੜੇ ਬੱਚੇ ਸਭ ਪਾ ਸਕਦੇ ਨੇ ਇਸ ਨੂੰ ਭੰਗੜਾ ਪਾ ਕੇ ਬੱਚੇ ਬਹੁਤ ਅਨੰਦ ਮਾਣਦੇ ਹਨ ਇਹ ਨਾਲ ਸਰੀਰ ਦੀਆਂ ਤਾਕਤ ਅਤੇ ਸਰੀਰ ਨੂੰ ਖੁਸ਼ੀਆਂ ਮਿਲਦੀਆਂ ਹਨ ਭੰਗੜਾ ਵਿਸਾਖੀ ਦੇ ਵਿੱਚ ਪਾ ਵਿਸਾਖੀ ਦੇ ਮੇਲੇ 'ਤੇ ਬੱਚੇ ਬਹੁ ਵੱਡੇ ਛੋਟੇ ਸਭ ਭੰਗੜਾ ਪਾਂਉਦੇ ਹਨ ਭੰਗੜੇ ਦੇ ਕੁਛ ਗੀਤ ਹਨ ਜੋ ਇਸ ਤਰ੍ਹਾਂ ਹਨ ਦੇ ਦੇ ਦੇ ਦੇ ਗੇੜਾ ਸ਼ੌਂਕ ਦਾ ਨਣਾਨੇ ਗੋਰੀਏ ਭਾਬੀ ਮੇਰੀ ਗੁੱਤ ਕਰਦੇ ਮੇਰੇ ਨੱਚਦੀ ਦੇ ਖੁੱਲ੍ਹ ਗਏ ਵਾਲ ਨੱਚਣ ਤੋਂ ਪਹਿਲਾਂ ਮੌਕਾ ਦਿਆਂਗੇ ਸਭਨਾ ਨੂੰ ਇੱਕ ਹੋਕਾ ਸਭਨਾ ਨੂੰ ਇੱਕ ਮੌਕਾ ਦਿਆਂਗੇ ਟੇਢੀ ਪੱਗ ਵਾਲਿਆਂ ਵੇ ਟੇਢੀ ਪੱਗ ਵਾਲਿਆਂ ਟੈਨਸ਼ਨ ਨਹੀਂ ਮਿੱਤਰਾਂ ਨੂੰ ਟੈਂ ਸ਼ਾਵਾ ਕਾਲੀ ਤੇਰੀ ਕਾਲੀ ਐਕਟਿਵ ਐਕਟਿਵਾ ਦਾ ਜੇ ਤੂੰ ਨੱਚੇਂਗੀ ਮੇਰੇ ਨਾਲ ਗੋਰੀਏ ਨੀ ਲਹਿੰਗੇ ਤੇ ਸ਼ਰਾਬ ਡੋਲ ਦੂੰ ਜੇ ਤੂੰ ਨੱਚੇਂਗੀ ਬਹਿ ਕੇ ਦੇਖ ਜਵਾਨਾਂ ਬਾਬੇ ਭੰਗੜਾ ਪਾਉਂਦੇ ਨੇ ਜੱਟ ਦਾ ਪਜਾਮਾ ਕੁੜੇ ਉੱਚਾ ਹੋ ਗਿਆ ਜੱਟ ਦਾ ਪਜਾਮਾ ਕੁੜੇ ਉੱਚਾ ਹੋ ਗਿਆ ਮਿੱਤਰਾਂ ਦੀ ਛੱਤਰੀ ਤੋਂ ਉੱਡਗੀ ਅੰਬਰਾਂ 'ਤੇ ਲਾਉਂਦੀ ਐਂ ਉਡਾਰੀਆਂ